ਵਿਗਿਆਨ ਅਤੇ ਤਕਨੋਲਜੀ ਨੇ ਸਾਡੀ ਮਹਾਮਾਰੀ ਦੇ ਦੌਰਾਨ ਲੋਕਾਂ ਦਾ ਬਹੁਤ ਹੀ ਧਿਆਨ ਰੱਖਿਆ ਹੈ ਅਤੇ ਬਹੁਤ ਹੀ ਉਨ੍ਹਾਂ ਦਾ ਮਦਦ ਕੀਤੀ ਹੈ ਜਿਵੇਂ ਕਿ ਇਹ ਇਹਨੇ ਜਿਵੇਂ ਕਿ ਕਲਾਸਾਂ ਵੀ ਬੱਚਿਆਂ ਦੀਆਂ ਔਨਲਾਈਨ ਲਗਾਈਆਂ ਹਨ ਤੇ ਜਾਂ ਤਾਂ ਜੋ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਨਾ ਹੋ ਸਕੇ ਅਤੇ ਡਾਕਟਰ ਵੀ ਔਨਲਾਈਨ ਹੀ ਪੇਸ਼ੈਂਟਸ ਨੂੰ ਟਰੀਟ ਕਰਦੇ ਸਨ ਅਤੇ ਜੇਕਰ ਅਸੀਂ ਕਿਤੇ ਜਾਣਾ ਹੋਵੇ ਟਿਕਟਾਂ ਵੀ ਅਸੀਂ ਘਰ ਬੈਠੇ ਹੀ ਬੁੱਕ ਕਰਾ ਸਕਦੇ ਹਨ ਅਤੇ ਸਾਡਾ ਵਿਗਿਆਨ ਨੇ ਬਹੁਤ ਹੀ ਸਾਥ ਦਿੱਤਾ ਹੈ ਅਤੇ ਸਾਡਾ ਕੰਮ ਵੀ ਬਹੁਤ ਹੀ ਸੌਖਾ ਕਰ ਦਿੱਤਾ ਹੈ ਤਕਨੋਲਜੀ ਨੇ ਲੋਕਾਂ ਦਾ ਕੰਮ ਬਹੁਤ ਸੌਖਾ ਕਰ ਦਿੱਤਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹੈ ਜੋ ਕਿ ਸਾਨੂੰ ਬ ਪ੍ਰੋਵਾਈਡ ਕੀਤੀਆਂ ਗਈਆਂ ਹਨ ਅਤੇ ਜਿੰਮ ਜਾਂ ਫਿਰ ਸਾਨੂੰ ਯੋਗਾ ਕਰਨ ਲਈ ਵੀ ਕਿਤੇ ਹੋਰ ਦੂਰ ਨਹੀਂ ਜਾਣਾ ਪੈਂਦਾ ਅਤੇ ਯੂਟਿਊਬ 'ਤੇ ਬਹੁਤ ਸਾਰੀਆਂ ਕਸਰਤ ਦੀਆਂ ਵੀਡੀਓਜ਼ ਹਨ ਜ ਜਿਨ੍ਹਾਂ ਨਾਲ਼ ਅਸੀਂ ਅੋਨ ਕਸਰਤ ਕਰ ਸਕਦੇ ਹਨ ਅਤੇ ਹੁਣ ਇਹਨਾਂ ਦੀਆਂ ਔਨਲਾਈਨ ਕਲਾਸਿਜ਼ ਵੀ ਲੱਗਦੀਆਂ ਹਨ